ਜੇਕਰ ਸੈਰ ਸਪਾਟੇ ਲਈ ਮੈਂ ਆਪਣੇ ਮਹਿਮਾਨਾਂ ਨੂੰ ਕਿਤੇ ਲੈ ਕੇ ਜਾਣਾ ਚਾਹਾਂ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਜ਼ਿਲ੍ਹੇ ਬਠਿੰਡੇ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਣਾ ਚਾਹਾਂਗੀ ਬਠਿੰਡੇ ਦੇ ਵਿੱਚ ਇੱਕ ਇਤਿਹਾਸਿਕ ਕਿਲ੍ਹਾ ਹੈ ਜਿੱਥੇ ਰਜੀਆ ਸੁਲਤਾਨਾ ਨੂੰ ਵੀ ਕੈਦ ਕਰਕੇ ਰੱਖਿਆ ਗਿਆ ਸੀ ਤਾਂ ਉਸ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਪੁਰਾਣੀਆਂ ਤੋਪਾਂ ਉੱਥੇ ਰੱਖੀਆਂ ਗਈਆਂ ਹਨ ਇੱਕ ਇਤਿਹਾਸ ਜਿਹੜਾ ਸਾਨੂੰ ਉਹ ਕਿਲ੍ਹਾ ਦੱਸਦਾ ਹੈ ਤਾਂ ਇਹ ਇੱਕ ਵਿਸ਼ੇਸ਼ ਟੂਰਿਜ਼ਮ ਦਾ ਸਥਾਨ ਹੈ ਇਸ ਤੋਂ ਇਲਾਵਾ ਬਠਿੰਡਾ ਦੇ ਵਿੱਚ ਹਾਜੀ ਰਤਨ ਗੁਰਦੁਆਰਾ ਹੈ ਉੱਥੇ ਵੀ ਮੈਂ ਆਪਣੇ ਮਹਿਮਾਨਾਂ ਨੂੰ ਲੈ ਕੇ ਜ਼ਰੂਰ ਜਾਵਾਂਗੀ ਇਸ ਤੋਂ ਇਲਾਵਾ ਝੀਲਾਂ ਹਨ ਝੀਲਾਂ ਹਰ ਇੱਕ ਦੀ ਖਿੱਚ ਦਾ ਇੱਕ ਕੇਂਦਰ ਬਣਦੀਆਂ ਹੁੰਦੀਆਂ ਹਨ ਤਾਂ ਝੀਲਾਂ 'ਤੇ ਮੈਂ ਆਪਣੇ ਮਹਿਮਾਨਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਲਿਜਾਣਾ ਪਸੰਦ ਕਰਾਂਗੀ ਇਸ ਤੋਂ ਇਲਾਵਾ ਬਠਿੰਡਾ ਦੇ ਵਿੱਚ ਰੋਜ਼ ਗਾਰਡਨ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੇ ਗੁਲਾਬ ਦੇ ਫੁੱਲ ਲੱਗੇ ਹੋਏ ਹਨ ਤਾਂ ਉੱਥੇ ਵੀ ਮਹਿਮਾਨਾਂ ਨੂੰ ਲੈ ਕੇ ਜਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਜੋਗਰਸ ਪਾਰਕ ਹੈ ਜੋ ਹਰਿਆਲੀ ਨਾਲ ਭਰਪੂਰ ਹੈ ਝੀਲਾਂ ਦੇ ਲਾਗੇ ਹੀ ਹੈ ਤਾਂ ਉੱਥੇ ਵੀ ਮਹਿਮਾਨਾਂ ਨੂੰ ਲੈ ਕੇ ਜਾਇਆ ਜਾ ਸਕਦਾ ਹੈ ਇਸ ਤੋਂ ਬਿਨਾਂ ਜੇ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਸਾਹਿਬ ਸਾਡਾ ਇੱਕ ਪਵਿੱਤਰ ਇਤਿਹਾਸਿਕ ਸਥਾਨ ਹੈ ਤਾਂ ਉੱਥੇ ਮੈਂ ਆਪਣੇ ਮਹਿਮਾਨਾਂ ਨੂੰ ਲਿਜਾਣਾ ਪਸੰਦ ਕਰਾਂਗੀ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਹਰਿਮੰਦਰ ਸਾਹਿਬ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹਨ ਉੱਥੇ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਜਾਣਾ ਪਸੰਦ ਕਰਾਂਗੀ ਤਾਂ ਕਿ ਉੱਥੇ ਨਤਮਸਤਕ ਹੋ ਸਕਣ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਣ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਜਲ੍ਹਿਆਂਵਾਲਾ ਬਾਗ ਹੈ ਜੋ ਇੱਕ ਸਾਡੇ ਇਤਿਹਾਸ ਨਾਲ ਜੁੜਿਆ ਹੋਇਆ ਹੈ ਤੇਰਾਂ ਅਪ੍ਰੈਲ ਉੱਨੀ ਸੌ ਉੱਨੀ ਦਾ ਇਤਿਹਾਸ ਸ ਅਸੀਂ ਜਦੋਂ ਵੀ ਉੱਥੇ ਜਾਂਦੇ ਹਾਂ ਜਲ੍ਹਿਆਂਵਾਲੇ ਬਾਗ ਤਾਂ ਸਾਡੇ ਅੱਖਾਂ ਦੇ ਸਾਹਮਣੇ ਮੁੜ ਤੋਂ ਜੀਵਿਤ ਹੋ ਜਾਂਦਾ ਹੈ ਇਸ ਤੋਂ ਇਲਾਵਾ ਦੇਖਿਆ ਜਾਵੇ ਤਾਂ ਕੁਝ ਹੋਰ ਟੂਰਿਸਟ ਪਲੇਸ ਵੀ ਪੰਜਾਬ ਦੇ ਵਿੱਚ ਹਨ ਜਿਹਨਾਂ ਦੇ ਵਿੱਚੋਂ ਅਸੀਂ ਪਟਿਆਲਾ ਚੰਡੀਗੜ੍ਹ ਕਹਿ ਸਕਦੇ ਹਾਂ ਪਟਿਆਲੇ ਮਾਤਾ ਦੁਰਗਾ ਦਾ ਜਿਹੜਾ ਮੰਦਰ ਹੈ ਉੱਥੇ ਮਹਿਮਾਨਾਂ ਨੂੰ ਲੈ ਕੇ ਜਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਦਾ ਰੌਕ ਗਾਰਡਨ ਸੁੱਖਨਾ ਲੇਕ 'ਤੇ ਇਲਾਂਟੇ ਮੋਲ ਦੇ ਵਿੱਚ ਵੀ ਮੈਂ ਮਹਿਮਾਨਾਂ ਨੂੰ ਲੈ ਕੇ ਜਾਣਾ ਪਸੰਦ ਕਰਾਂਗੀ ਕਿਉਂਕਿ ਬਹੁਤ ਹੀ ਪ੍ਰਸਿੱਧ ਟੂਰਿਸਟ ਪਲੇਸ ਹਨ